ਹੈਲੋ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਦੱਸੋ ਜੀ ਤਰੀਕ ਕਿਹੜੀ ਜੀ ਤੁਹਾਡੀ ਫਰਵਰੀ ਦੀ ਹੈ ਜੀ ਅੱਛਾ ਜੀ ਕਿਆ ਕਿਆ ਪ੍ਰੋਗਰਾਮ ਚਾਹੀਦਾ ਜੀ ਤੁਹਾਨੂੰ ਲੇਡੀਜ਼ ਸੰਗੀਤ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਪੈਲੇਸ ਕਰਨਾ ਹੈ ਕਿ ਕਮਿਊਨਟੀ ਸੈਂਟਰ 'ਚ ਕਿ ਬਾਹਰ ਟੈਂਟ ਲਗਾ ਕੇ ਜੀ ਕਮਿਊਨਟੀ ਸੈਂਟਰ ਕਰਨਾ ਹੈ ਜੀ ਫੇਰ ਤਾਂ ਤੁਹਾਡਾ ਟੈਂਟ ਥੋੜ੍ਹਾ ਲੱਗੇਗਾ ਜੇ ਤੁਸੀਂ ਉੱਥੇ ਕਰਨਾ ਹੈਗਾ ਪੈਲਸ 'ਚ ਫੇਰ ਤੁਹਾਡਾ ਪੈਲਸ ਦਾ ਤਾਂ ਦੋ ਲੱਖ ਢਾਈ ਲੱਖ ਰੁਪਏ ਦਾ ਪੈ ਤੁਹਾਡੀ ਪਲੇਟ ਸਿਸਟਮ ਕਰਨੀ ਹੈ ਕਿ ਤੁਸੀਂ ਆਪਣਾ ਬਣਵਾਉਣਾ ਹੈ ਜੀ ਜੇ ਪਲੇਟ ਸਿਸਟਮ ਕਰਦੇ ਤੁਹਾਨੂੰ ਹਜ਼ਾਰ ਰੁਪਇਆ ਪਲੇਟ ਲੱਗੇਗੀ ਜੀ ਹਾਂਜੀ ਉਹ 'ਚ ਤੁਹਾਨੂੰ ਮਿਲੇ ਉਹ 'ਚ ਮਿਲੇਗਾ ਜੀ ਤੁਹਾਨੂੰ ਛੇ ਤਰ੍ਹਾਂ ਦੀ ਸਬਜ਼ੀ ਦੋ ਤਰ੍ਹਾਂ ਦੇ ਚਾਵਲ ਦਹੀਂ ਚਾਰ ਤਰ੍ਹਾਂ ਦੇ ਸਲਾਦ ਚਾਰ ਪੰਜ ਤੋਂ ਛੇ ਸਬਜ਼ੀਆਂ ਮਿਲਣਗੀਆਂ ਜੀ ਸਨੈਕਸ ਵੀ ਮਿਲਣਗੇ ਜੇ ਤੁਹਾਨੂੰ ਫਰੂਟ ਚਾਟ ਚਾਹੀਦਾ ਹੈ ਉਹ ਵੀ ਦੱਸੋ ਜੀ ਅੱਛਾ ਜੀ ਚਲੋ ਜੀ ਠੀਕ ਹੈ ਤੁਹਾਡਾ ਸਭ ਹੋ ਜੇਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਓਕੇ